ਮੈਂ ਐਮਾਜੋਨ ਤੋਂ ਇੱਕ ਲੈਪਟੋਪ ਆਰਡਰ ਕੀਤਾ ਦੇਖਣ ਵਿੱਚ ਤਾਂ ਉਹ ਬਹੁਤ ਵਧੀਆ ਸੀ ਅਤੇ ਉਹ ਬਹੁਤ ਮਹਿੰਗਾ ਸੀ ਜਦੋਂ ਉਹ ਅਸੀਂ ਉਸਨੂੰ ਓਪਨ ਕੀਤਾ ਤਾਂ ਉਹ ਬਿਲਕੁਲ ਖ਼ਰਾਬ ਸੀ ਉਸ ਦੀ ਇੱਕ ਬਟਨ ਕੰਮ ਨਹੀਂ ਕਰ ਰਹੀ ਸੀ ਕਰਦੇ ਅਤੇ ਉਸਦੀ ਸਕਰੀਨ ਵੀ ਟੁੱਟੀ ਹੋਈ ਸੀ ਇੱਕ ਡਿਲੀਵਰੀ ਵਾਲੇ ਨੇ ਵੀ ਸਾਨੂੰ ਬਹੁਤ ਹੀ ਜ਼ਿਆਦਾ ਤੰਗ ਕੀਤਾ ਅਤੇ ਜਦੋਂ ਲੈਪਟਾਪ ਘਰ ਆਇਆ ਤਾਂ ਉਹ ਬਿਲਕੁਲ ਖ਼ਰਾਬ ਸੀ ਮੈਂ ਮੈਂ ਕਹਿੰਦਾ ਹਾਂ ਕਿ ਆਹ ਕਿ ਤੁਸੀਂ ਵੀ ਐਮਾਜੋਨ ਤੋਂ ਕੋਈ ਚੀਜ਼ ਆਰਡਰ ਨਾ ਕਰੋ